ਬੀ ਆਰ ਐਸ ਨਗਰ ਮਾਡਲ ਟਾਊਨ ਆਤਮ ਨਗਰ ਗਿੱਲ ਰੋਡ ਵਿਸ਼ਵਕਰਮਾ ਚੌਂਕ ਢੋਲੇਵਾਲ ਸ਼ੇਰਪੁਰ ਚੌਂਕ ਕਿਪਸ ਮਾਰਕੀਟ ਏ ਸੀ ਮਾਰਕੀਟ ਫੀਲਡ ਗੰਜ ਰਾਮਨਗਰ ਪ੍ਰਭਾਤ ਨਗਰ ਪ੍ਰਤਾਪ ਨਗਰ ਭਾਰਤ ਨਗਰ